ਵੇਟਰ ਮੈਨੇਜਰ ਸਾਹਿਬ ਨੂੰ ਬੁਲਾਉ ਮੈਨੇਜਰ ਸਾਹਿਬ ਮੈਂ ਤੁਹਾਡੇ ਇੱਧਰ ਰੈਗੂਲਰ ਕਸਟਮਰ ਹਾਂ ਅੱਗੇ ਵੀ ਆਈਦਾ ਹੈ ਰੋਟੀ ਅੱਗੇ ਵਧੀਆ ਹੁੰਦੀ ਹੈ ਅੱਜ ਦੇਖੋ ਕਿੰਨਾ ਖਰਾਬ ਭੋਜਨ ਦਿੱਤਾ ਤੁਹਾਡੇ ਰੋਟੀਆਂ ਬਾਸੀ ਨੇ ਅਤੇ ਸਬਜ਼ੀ 'ਚ ਵੀ ਕੋਕਰੇਚ ਹੈ ਮੈਨੂੰ ਤੁਹਾਡੇ ਨਾਲ ਇਹ ਉਮੀਦ ਨਹੀਂ ਸੀਗੀ ਮੈਂ ਪੂਰੇ ਪਰਿਵਾਰ ਨਾਲ ਆਇਆ ਉਰੇ ਰੋਟੀ ਖਾਂਦੇ ਹੋਏ ਸਾਰਾ ਮੂੜ ਖਰਾਬ ਹੋ ਗਿਆ ਅੱਗੇ ਦੀ ਸਾਨੂੰ ਇੱਧਰ ਆਈਏ ਵੀ ਕੁਛ ਵਧੀਆ ਤਰੀਕੇ ਨਾਲ ਪੇਸ਼ ਕਰੋ ਅੱਗੇ ਤਾਂ ਸਾਫ ਸਫਾਈ ਹੁੰਦੀ ਆ ਐਤਕੀ ਤਾਂ ਬਹੁਤ ਗੰਦਾ ਰੱਖਿਆ ਹੋਇਆ ਤੁਸੀਂ ਰੈਸਟੋਰੈਂਟ ਕਿਉਂ ਨਹੀਂ ਕਲੀਅਰ ਕਲੀਨ ਕਰਦੇ ਉਰੇ ਹੋਰ ਅੱਗੇ ਤੁਸੀਂ ਆਹ ਬੰਦੇ ਵਧੀਆ ਰੱਖੋ ਜਿਹੜੇ ਉਰੇ ਟੇਬਲ ਵਗੈਰਾ ਚੰਗੀ ਤਰ੍ਹਾਂ ਸਾਫ ਰੱਖਣ ਆਹ ਰੋਟੀ ਪਾਣੀ ਲਿਆਉਂਦੇ ਆ ਤਾਂ ਕੁਛ ਇਹਦੇ 'ਚ ਖਰਾਬੀ ਨਾ ਨਿਕਲੇ ਇਹ ਉੱਧਰੋਂ ਵੇਖ ਕੇ ਲਿਆਉਣ ਇਹ ਦੇਖੋ ਕੋਕਰੇਚ ਨਿਕਲ ਰਹੇ ਇੱਧਰ ਸਬਜ਼ੀ 'ਚੋਂ ਜੇ ਇਹੀ ਹਾਲ ਰਿਹਾ ਫਿਰ ਕਿਹੜਾ ਕਸਟਮਰ ਆ ਕੇ ਤੁਹਾਡੇ ਇੱਧਰ ਖਾਵੇਗਾ